ਸਤਿ ਸ਼੍ਰੀ ਅਕਾਲ ਜੀ ਭਾਅ ਜੀ ਫਸਲ ਤਾਂ ਇਸ ਵਾਰੀ ਹੋਈ ਨਹੀਂ ਚੱਜ ਨਾਲ ਜੀ ਉਹ ਇਸ ਕਦੇ ਬੇਮੌਸਮਾਂ ਮੀਂਹ ਪੈ ਜਾਂਦਾ ਵਾ ਕਦੇ ਕੋਰੇ ਕਰਕੇ ਖਰਾਬ ਹੋ ਜਾਂਦੀ ਹੈ ਕਦੇ ਕੁਛ ਕਦੇ ਕੁਛ ਕੀ ਕਰੀਏ ਭਾਅ ਜੀ ਹੋਰ ਮੀਂਹ ਕਰਕੇ ਮੀਂਹ ਮਾਰੀ ਕਰਕੇ ਐਸ ਕਿੰਨੀ ਫਸਲ ਤਾ ਇੱਦਾਂ ਖਰਾਬ ਹੋ ਗਈ ਆ ਅੱਧੀ ਰੁੜ ਗਈ ਆ ਅੱਧੀ ਕੋਰੇ ਨੇ ਖਰਾਬ ਕਰ ਛੱਡੀ ਆ ਬਹੁਤ ਹੀ ਘਾਟਾ ਹੋ ਗਿਆ ਇਸ ਵਾਰ ਤਾਂ ਆਹ ਜਿਹੜੇ ਤਾਪ ਤਾਪਮਾਨ ਕਰਕੇ ਫਸਲ ਸੜੀ ਜਾਣਦੀ ਐਤਕੀ ਕਰੀਏ ਕੀ ਕਰ ਸਕਦੇ ਹਾਂ ਰੱਬ ਦੀ ਨੀਤੀ ਹੈ ਜੀ ਉਹ ਪਰਾਲੀ ਪਰਾਲੀ ਸਾੜਨ ਕਰਕੇ ਪ੍ਰਦੂਸ਼ਿਤ ਕਰੀ ਜਾਂਦੇ ਆ ਜਿਹਦੇ ਕਰਕੇ ਧੂੰਆਂ ਕੋਰਾ ਸਾਰਾ ਪਈ ਜਾਂਦਾ ਵਾ ਇਹਨਾਂ ਨੂੰ ਚਾਹੀਦਾ ਵੀ ਇਹਨੂੰ ਸਟੋਰ ਕਰਨੀ ਚਾਹੀਦੀ ਹੈ ਕਿਤੇ ਕਿਸੇ ਚੰਗੇ ਕੰਮ ਲਗਾਉਣੀ ਚਾਹੀਦੀ ਹੈ ਪਤਾ ਨਹੀਂ ਮਾੜਾ ਕੰਮ ਕਰੀ ਜਾਂਦੇ ਅਤੇ ਪ੍ਰਦੂਸ਼ਣ ਫੈਲਾਈ ਜਾਂਦੇ ਆ ਇਹਦੇ ਨਾਲ ਬਹੁਤ ਗਲੋਬਲ ਵਾਰਮਿੰਗ ਹੋ ਰਹੀ ਹੈ ਹਾਂਜੀ ਜੀ ਚਲੋ ਕੋਈ ਨਹੀਂ ਸੋਚ ਵਿਚਾਰ ਕਰਦੇ ਹਾਂ ਇਹ 'ਤੇ ਮੋਰਚਾ ਮੇਰਾ ਮੇਰਾ ਮਾਨਨਾ ਕਿ ਮੋਰਚਾ ਮੋਰਚਾ ਮੋਰਚਾ ਮੋਰਚਾ ਲਾਈਏ ਆਪਾਂ ਇਹਨਾਂ 'ਤੇ ਠੀਕ ਹੈ ਜੀ ਠੀਕ ਹੈ ਚਲੋ ਓਕੇ ਬਾਏ ਜੀ